ਅਸੀਂ ਹਰਿਮੰਦਰ ਸਾਹਿਬ ਗੁਰਦੁਆਰਾ ਵਿਖੇ ਗਏ ਉੱਥੋਂ ਦਾ ਸਾਨੂੰ ਗੁਰਦੁਆਰਾ ਬਹੁਤ ਹੀ ਵਧੀਆ ਲੱਗਿਆ ਸਾਨੂੰ ਉੱਥੋਂ ਦੇ ਗੁਰਦੁਆਰੇ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਉੱਥੋਂ ਦੇ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜੋ ਕਿ ਪੀਟੀਸੀ ਚੈਨਲ ਪ੍ਰੋਗਰਾਮ ਲਾਈਵ ਦੇਖਣ ਨੂੰ ਵੀ ਸਾਨੂੰ ਮਿਲਿਆ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਲੰਗਰ ਦੀ ਸੇਵਾ ਕੀਤੀ ਗੁਰਦੁਆਰੇ ਦੀਆਂ ਬਹੁਤ ਇਤਿਹਾਸਿਕ ਜਾਣਕਾਰੀ ਪ੍ਰਾਪਤ ਮਿਲੀ ਅਤੇ ਉੱਥੇ ਦੇ ਸਾਨੂੰ ਬਹੁਤ ਅਨੰਦ ਖੁਸ਼ੀ ਪ੍ਰਾਪਤ ਹੋਈ ਨਾਲੇ ਸ਼੍ਰੀ ਗੁਰਦੁਆਰਾ ਸ ਗੁਰੂ ਹਰਿਮੰਦਰ ਸਾਹਿਬ ਬਾਰੇ ਸਾਨੂੰ ਹਿਸਟਰੀ ਵਿੱਚ ਬਹੁਤ ਜਾਣਕਾਰੀ ਮਿਲਦੀ ਹੈ ਤਾਂ ਜੋ ਅਸੀਂ ਉੱਥੇ ਜਾ ਕੇ ਦੇਖ ਕੇ ਸਾਨੂੰ ਪਤਾ ਚੱਲਿਆ ਉਸ ਜਾਣਕਾਰੀ ਬਾਰੇ ਸ਼੍ਰੀ ਹਰਿਮੰਦਰ ਸਾਹਿਬ ਬਾਰੇ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਹਰਿਮੰਦਰ ਸਾਹਿਬ ਹਰ ਹਰਿਮੰਦਰ ਸਾਹਿਬ ਦੀ ਜੋ ਕਿ ਬਾਣੀ ਬਹੁਤ ਹੀ ਬਹੁਤ ਹੀ ਵਧੀਆ ਸੀ ਜੋ ਸੁਣ ਕੇ ਸਾਨੂੰ ਬਹੁਤ ਚੰਗਾ ਲੱਗਿਆ ਮਨ ਨੂੰ ਸ਼ਾਂਤੀ ਮਿਲੀ ਹਰਿਮੰਦਰ ਸਾਹਿਬ ਅਸੀਂ ਸਾਰਾ ਪਰਿਵਾਰ ਹੀ ਇਕੱਠਾ ਹੋ ਕੇ ਗਏ ਉੱਥੋਂ ਦੇ ਦਰਸ਼ਨ ਕੀਤੇ ਸਰੋਵਰ 'ਚ ਅਸੀਂ ਇਸ਼ਨਾਨ ਕੀਤਾ ਅਤੇ ਉੱਥੋਂ ਦੇ ਗੁਰਦੁਆਰੇ ਦੇ ਦਰਸ਼ਨ ਕੀਤੇ ਅਤੇ ਅਸੀਂ ਹਰਿਮੰਦਰ ਸਾਹਿਬ ਜੀ ਦੀ ਫੋਟੋ ਵੀ ਆਪਣੇ ਘਰ ਲੈ ਕੇ ਆਏ